ਸਮਾਰਟ ਫ਼ੋਨ ਬਣਾਇਆ ਭਾਵੇਂ ਮਨੁੱਖ ਨੇ ਹੀ ਹੈ ਪਰ ਮਨੁੱਖ ਨਾਲੋਂ ਜ਼ਿਆਦਾ ਸਮਾਰਟ ਹੋ ਗਿਆ ਹੈ ਮੁੱਢਲਾ ਜਿਹੜਾ ਉਪਯੋਗ ਹੈ ਅ ਸਮਾਰਟ ਫ਼ੋਨ ਦਾ ਉਹ ਸਿਰਫ਼ ਇੱਕ ਮਨੁੱਖ ਦੁਆਰਾ ਦੂਜੇ ਮਨੁੱਖ ਨੂੰ ਬੁਲਾਉਣ ਲਈ ਜਾਂ ਸੁਨੇਹਾ ਭੇਜਣ ਲਈ ਕੀਤਾ ਕਰਨ ਲਈ ਬਣਾਇਆ ਗਿਆ ਸੀ ਹੁਣ ਇਸੇ ਮੋਬਾਇਲ ਫੋਨ ਦੇ ਉੱਤੇ ਜਾਂ ਸਮਾਰਟ ਮੋਬਾਇਲ ਫੋਨ ਦੇ ਉੱਤੇ ਈਮੇਲ ਕਰਕੇ ਮੈਸੇਜ ਭੇਜ ਕੇ ਵੱਅਟਸਅੱਪ ਐਪ ਰਾਹੀਂ ਵੱਖ ਵੱਖ ਤਰ੍ਹਾਂ ਦੀਆਂ ਅ ਜਾਣਕਾਰੀਆਂ ਆਦਾਨ ਪ੍ਰਦਾਨ ਕੀਤੀਆਂ ਜਾ ਸਕਦੀਆਂ ਨੇ ਦੂਜੀ ਗੱਲ ਇਸੇ ਮੋਬਾਇਲ ਫ਼ੋਨ ਨੇ ਕੈਮਰੇ ਦੀ ਥਾਂ ਕੈਮਰਾ ਵੀ ਇਹਦੇ ਵਿੱਚ ਹੀ ਹੈ ਉਹਨੇ ਫ਼ੋਟੇਆਂ ਖਿੱਚਣ ਲਈ ਵੀ ਕੈਮਰੇ ਦੀ ਜਾਂ ਦੂਜਾ ਜਿਹੜਾ ਕੈਮਰਾ ਹੈ ਡਿਜ਼ੀਟਲ ਕੈਮਰਾ ਹੈਗਾ ਉਸਦੀ ਥਾਂ ਵੀ ਲੈ ਲਈ ਹੈ ਮੰਨੋਰੰਜਨ ਕਰਨ ਲਈ ਯੂਟਿਊਬ ਫਿਲਮਾਂ ਜਾਂ ਇੰਟਰਨੈੱਟ ਉੱਤੇ ਮਿਲਣ ਵਾਲੀ ਹਰ ਤਰ੍ਹਾਂ ਦੀ ਜਾਣਕਾਰੀ ਜਾਂ ਜਾਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮਿਲਦੀਆਂ ਨੇ ਤੀ ਅਗਲੀ ਗੱਲ ਜਿਹੜੀ ਹੈਗੀ ਹੈ ਕਿਸੇ ਵੀ ਤਰ੍ਹਾਂ ਦੀ ਪੇਅਮੈਂਟ ਦਾ ਲੈਣ ਦੇਣ ਜਾਂ ਰੁਪਏ ਦਾ ਲੈਣ ਦੇਣ ਕਰਨ ਲਈ ਵੀ ਬੈਂਕ 'ਚ ਜਾਣ ਦੀ ਲੋੜ ਨਹੀਂ ਹਰ ਤਰ੍ਹਾਂ ਦੀ ਪੇਅਮੈਂਟ ਇਸੇ ਮੋਬਾਇਲ ਫ਼ੋਨ ਤੋਂ ਅਲੱਗ ਅਲੱਗ ਤਰ੍ਹਾਂ ਦੀਆਂ ਅ ਜਿਹੜੀਆਂ ਐਪਸ ਬਣੀਆਂ ਹੋਈਆ ਨੇ ਜਿਵੇਂ ਕਿ ਯੂ ਪੀ ਆਈ ਐਪ ਹੈਗੀ ਹੈ ਉਹਦੇ ਨਾਲ ਕੀਤੀ ਜਾ ਸਕਦੀ ਹੈ ਜਾਂ ਪੇਅਬ ਪੇਮੈਂਟਸ ਵਾਲੀਆਂ ਜਿਹੜੀਆਂ ਐਪਸ ਨੇ ਉਹਨਾਂ ਨਾਲ ਕੀਤੀ ਕੈਲਕੁਲੇਟਰ ਵੀ ਇਹਦੇ ਅੰਦਰ ਹੀ ਬਣਿਆ ਹੋਇਆ ਜਿਸ ਨਾਲ ਹਰ ਤਰ੍ਹਾਂ ਦੀ ਕੈਲਕੁਲ਼ੇਸ਼ਨ ਕੀਤੀ ਜਾ ਸਕਦੀ ਹੈ ਅਤੇ ਦੂਦਾ ਦੂਜਾ ਅਲੱਗ ਤਰ੍ਹਾਂ ਦਾ ਜਿਹੜਾ ਕੈਲਕੁਲੇਟਰ ਹੈਗਾ ਉਸਦੀ ਥਾਂ ਵੀ ਖ਼ਤਮ ਕਰ ਦਿੱਤੀ ਹੈ ਇਸੇ ਮੋਬਾਇਲ ਸਮਾਰਟ ਫ਼ੋਨ ਨੇ ਸਾਨੂੰ ਹਰ ਤਰ੍ਹਾਂ ਦੇ ਨਕਸ਼ੇ ਜਾਂ ਥਾਵਾਂ ਨੂੰ ਲੱਭਣ ਲਈ ਵੀ ਮੁਹੱਈਆ ਫੇਸਿਲੀਟੀ ਮੁਹੱਈਆ ਕਰਵਾਈ ਹੈ ਹਰ ਤਰ੍ਹਾਂ ਦੀ ਕਾਲਿੰਗ ਵੀਡਿਓ ਕਾਲ ਜਾਂ ਵੁਆਇਸ ਕਾਲ ਇਸ ਰਾਹੀਂ ਕੀਤੀ ਜਾ ਸਕਦੀ ਹੈ ਸਭ ਤੋਂ ਉਪਯੋਗੀ ਥਾਂ ਇਹਦੀ ਜਿਹੜੀ ਕੋਵਿਡ ਦੇ ਵਿੱਚ ਵੀ ਕੀਤੀ ਜਾਂਦੀ ਰਹੀ ਹੈ ਹਰ ਤਰ੍ਹਾਂ ਦੇ ਸਕੂਲਾਂ ਦੀ ਕਾਲਜਾਂ ਯੂਨੀਵਰਸਿਟੀਆਂ ਦੀਆਂ ਕਲਾਸ ਰੂਮ ਟੀਚਿੰਗ ਵੀ ਅ ਸਮਾਰਟ ਫ਼ੋਨ ਦੇ ਦੁਆਰਾ ਹੀ ਕਰਵਾਦੀ ਕਰਵਾਈ ਜਾਂਦੀ ਰਹੀ ਹੈ